ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਛਾ ਕਿਹੜੇ ਦੋਸਤ ਨੇ ਨੰਬਰ ਦਿੱਤਾ ਸੀ ਤੁਹਾਨੂੰ ਮੇਰਾ ਅੱਛਾ ਤੁਹਾਡਾ ਨਾਮ ਕੀ ਹੈ ਅੱਛਾ ਵੈਸੇ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਅੱਛਾ ਤਾਂ ਤੁਸੀਂ ਘੁੰਮਣਾ ਚਾਹੁੰਦੇ ਹੋ ਬਠਿੰਡਾ ਬਠਿੰਡਾ ਸੈਂਟਰਲ ਯੂਨੀਵਰਸਿਟੀ ਦੇ ਵਿੱਚ ਪੜ੍ਹ ਰਹੇ ਹੋ ਤੁਸੀਂ ਮ ਕੀ ਮੈਂ ਜਾਣ ਸਕਦੀ ਹਾਂ ਵੀ ਤੁਹਾਨੂੰ ਛੁੱਟੀਆਂ ਕਦੋਂ ਹਨ ਅਤੇ ਜਾਂ ਤੁਸੀਂ ਕਦੋਂ ਘੁੰਮਣ ਦੇ ਇੱਛੁਕ ਹੋ ਮਤਲਬ ਇਸੇ ਹਫਤੇ ਦੇ ਵਿੱਚ ਤਾਂ ਜੇਕਰ ਤੁਸੀਂ ਘੁੰਮਣਾ ਚਾਹੁੰਦੇ ਹੋ ਤਾਂ ਇੱਥੇ ਨਾ ਕਈ ਸਾਰੇ ਮਤਲਬ ਸਥਾਨ ਜਿਹੜੇ ਬਠਿੰਡੇ ਦੇ ਵਿੱਚ ਹੈਗੇ ਨੇ ਕੁਝ ਇਤਿਹਾਸਿਕ ਜਗ੍ਹਾ ਵੀ ਹੈਗੀਆਂ ਨੇ ਅਤੇ ਇਸ ਤੋਂ ਇਲਾਵਾ ਕੁਝ ਟੂਰਿਸਟ ਪਲੇਸ ਵੀ ਹੈਗੇ ਨੇ ਜਿਵੇਂ ਇਤਿਹਾਸਿਕ ਦੇ ਵਿੱਚ ਇੱਕ ਇੱਥੇ ਕਿਲ੍ਹਾ ਮੁਬਾਰਕ ਆ ਅਤੇ ਸ਼ਾਇਦ ਤੁਹਾਨੂੰ ਪਤਾ ਹੋਵੇ ਜਿੱਥੇ ਰਜ਼ੀਆ ਸੁਲਤਾਨ ਨੂੰ ਵੀ ਕੈਦ ਕਰਕੇ ਰੱਖਿਆ ਗਿਆ ਸੀਗਾ ਅਤੇ ਉਹ ਉਹ ਕਿਲ੍ਹਾ ਬੜਾ ਹੀ ਇਤਿਹਾਸਿਕ ਹੈਗਾ ਤਾਂ ਉੱਥੇ ਪੁਰਾਣੀਆਂ ਜਿਵੇਂ ਤੋਪਾਂ ਵਗੈਰਾ ਵੀ ਰੱਖੀਆਂ ਗਈਆਂ ਨੇ ਗੁਰਦੁਆਰਾ ਸਾਹਿਬ ਉਹਦੇ ਵਿੱਚ ਬਣਿਆ ਹੋਇਆ ਇੱਕ ਤਾਂ ਤੁਸੀਂ ਉੱਥੇ ਜਾ ਸਕਦੇ ਹੋ ਇਸ ਤੋਂ ਇਲਾਵਾ ਜਿਵੇਂ ਕਿ ਇੱਥੇ ਲੇਕਸ ਹੈਗੀਆਂ ਨੇ ਝੀਲਾਂ ਝੀਲਾਂ ਤੇ ਜਾ ਸਕਦੇ ਹੋ ਤੁਸੀਂ ਮਨੋਰੰਜਨ ਦਾ ਇੱਕ ਵਧੀਆ ਸਾਧਨ ਹੈਗਾ ਅਤੇ ਇਸ ਤੋਂ ਇਲਾਵਾ ਤੁਸੀਂ ਮਿੱਤਲ ਮੋਲ ਘੁੰਮ ਸਕਦੇ ਹੋ ਜਿੱਥੇ ਕਿ ਸ਼ੋਪਿੰਗ ਲਈ ਵੀ ਕਾਫੀ ਵਧੀਆ ਹੈਗਾ ਕਈ ਤਰ੍ਹਾਂ ਦੀਆਂ ਤੁਹਾਨੂੰ ਚੀਜ਼ਾਂ ਮਿਲ ਜਾਣਗੀਆਂ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਅਤੇ ਇਸ ਤੋਂ ਇਲਾਵਾ ਤੁਸੀਂ ਜਿਵੇਂ ਕਿ ਜੇ ਪਾਰਕਾਂ ਦੀ ਗੱਲ ਕਰੀਏ ਤਾਂ ਜੋਗਰਸ ਪਾਰਕ ਹੈਗਾ ਬਠਿੰਡੇ ਵਾਟਰ ਪਾਰਕ ਹੈਗਾ ਉੱਥੇ ਜਾ ਸਕਦੇ ਹੋ ਚੇਤਕ ਪਾਰਕ ਹੈਗਾ ਉੱਥੇ ਜਾ ਸਕਦੇ ਹੋ ਅਤੇ ਇਹ ਤੋਂ ਬਿਨਾਂ ਚਿੜੀਆ ਘਰ ਵੀ ਹੈਗਾ ਕਈ ਤਰ੍ਹਾਂ ਦੇ ਜਾਨਵਰ ਜਿਹੜੇ ਉੱਥੇ ਹੈਗੇ ਨੇ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਹੜੇ ਕਿ ਆਮ ਕਰਕੇ ਆਪਾਂ ਨੂੰ ਨਹੀਂ ਮਿਲਦੇ ਹੁੰਦੇ ਤਾਂ ਉੱਥੇ ਉਨ੍ਹਾਂ ਨੂੰ ਰੱਖਿਆ ਗਿਆ ਹੈਗਾ ਤਾਂ ਤੁਸੀਂ ਦੇਖ ਸਕਦੇ ਹੈਗੇ ਅਤੇ ਇਸ ਤੋਂ ਇਲਾਵਾ ਬਠਿੰਡਾ ਰੋਜ਼ ਗਾਰਡਨ ਵੀ ਬਣਿਆ ਹੋਇਆ ਹੈਗਾ ਰੋਜ਼ ਗਾਰਡਨ ਤੁਸੀਂ ਜਾ ਸਕਦੇ ਹੋ ਅਤੇ ਬਾਕੀ ਇੱਕ ਇੱਥੇ ਸ਼ੋਪਿੰਗ ਲਈ ਹੋਰ ਵੀ ਬੜੀ ਵਧੀਆ ਜਗ੍ਹਾ ਬਣੀ ਹੋਈ ਆ ਅਂ ਫੈਕਟਰੀ ਆਊਟਲੈਟ ਉੱਥੇ ਤੁਸੀਂ ਜਾ ਸਕਦੇ ਹੋ ਅਤੇ ਇਹ ਤੋਂ ਬਿਨ ਹਾਂਜੀ ਹਾਂ ਘੁੰਮਣ ਲਈ ਦੇਖੋ ਕਿਉਂਕਿ ਹੁਣ ਗਰਮੀਆਂ ਦਾ ਮੌਸਮ ਚੱਲ ਰਿਹਾ ਹੈਗਾ ਤਾਂ ਹੁਣ ਦੁਪਹਿਰ ਵਾਲਾ ਟਾਈਮ ਤਾਂ ਘੁੰਮਣ ਲਈ ਸਹੀ ਨਹੀਂ ਹੈਗਾ ਤਾਂ ਤੁਸੀਂ ਜਾਂ ਤਾਂ ਸਵੇਰ ਦਾ ਟਾਈਮ ਰੱਖੋ ਅਤੇ ਜਾਂ ਫਿਰ ਸ਼ਾਮ ਦਾ ਜਿਵੇਂ ਕਿ ਪੰਜ ਕੁ ਵਜੇ ਦੇ ਆਸ ਪਾਸ ਦਾ ਟਾਈਮ ਰੱਖ ਲਓ ਤਾਂ ਉਹ ਦੇਖਣ ਲਈ ਤੁਹਾਡਾ ਵਧੀਆ ਰਹੇਗਾ ਹਾਂਜੀ

ਹਾਂਜੀ ਹਾਂਜੀ ਕੈਬ ਬੁੱਕ ਮੈਂ ਕਰਵਾ ਸਕਦੀ ਹਾਂ ਅਤੇ ਤੁਹਾਨੂੰ ਕਰਵਾ ਦੇਵਾਂਗੀ ਕੈਬ ਬੁੱਕ ਤਾਂ ਤੁਸੀਂ ਮੈਨੂੰ ਆਪਣਾ ਪੱਕਾ ਕਨਫਰਮ ਕਰਕੇ ਦੱਸ ਦਿਓ ਵੀ ਤੁਸੀਂ ਕਿਹੜੇ ਟਾਈਮ 'ਤੇ ਆਉਣਾ ਪਸੰਦ ਕਰੋਗੇ ਅੱਛਾ ਇਹ ਤੁਹਾਡਾ ਆਪਣਾ ਨੰਬਰ ਹੀ ਹੈ ਨਾ ਅੱਛਾ ਠੀਕ ਹੈ ਫਿਰ ਮੈਂ ਤੁਹਾਨੂੰ ਇਸੇ ਨੰਬਰ 'ਤੇ ਨਾ ਕੈਬ ਦਾ ਪਤਾ ਕਰਕੇ ਕੋਲ ਬੈਕ ਕਰਾਂਗੀ ਠੀਕ ਹੈ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ